ਮੈਂ ਹਮੇਸ਼ਾ ਸਵੇਰੇ ਪੰਜ ਵਜੇ ਉੱਠਦਾ ਹਾਂ ਦੋੜਨ ਲਈ ਮੈਂ ਹਮੇਸ਼ਾ ਆਪਣੇ ਘਰ ਦੇ ਕੋਲੇ ਪਲੇ ਗਰਾਊਂਡ ਹੈ ਉਸ ਦੇ ਦਸ ਚੱਕਰ ਲਗਾਉਂਦਾ ਹਾਂ ਜੋ ਕਿ ਉਹ ਇੱਕ ਵਾਰ ਚ ਪੰਜ ਸੌ ਮੀਟਰ ਦਾ ਹੈ ਮੈਂ ਹਮੇਸ਼ਾ ਆਪਣੀ ਸਿਹਤ ਦਾ ਖਿਆਲ ਰੱਖਦਾ ਹਾਂ ਮੈਂ ਹਮੇਸ਼ਾ ਨਿਯਮਾਂ ਨਾਲ ਚੱਲਦਾ ਹਾਂ ਜੋ ਕਿ ਮੈਂ ਇੱਕ ਦਿਨ ਵਿੱਚ ਸੱਤ ਤੋਂ ਅੱਠ ਲੀਟਰ ਪਾਣੀ ਪੀਂਦਾ ਹਾਂ ਜੋ ਕਿ ਸਾਡੀ ਬੋਡੀ ਲਈ ਬਹੁਤ ਜ਼ਰੂਰੀ ਹੈ ਮੈਂ ਸਾਨੂੰ ਹੁ ਪ੍ਰੋਟੀਨ ਮਾਸ ਮੱਛੀ ਅੰਡਾ ਵਗੈਰਾ ਤੋਂ ਬਹੁਤ ਜ਼ਿਆਦਾ ਮਿਲ ਸਕਦਾ ਹੈ ਦਾਲਾਂ ਅਤੇ ਦਾਲਾਂ ਸਬਜ਼ੀ ਤੋਂ ਵੀ ਸਾਨੂੰ ਬਹੁਤ ਜ਼ਿਆਦਾ ਪ੍ਰੋਟੀਨ ਮਿਲ ਸਕਦਾ ਹੈ